ਵਿਆਹਾਂ ਵਰਗੇ ਵੱਡੇ ਸਮਾਰੋਹ ਦੌਰਾਨ ਵੱਡੀ ਮਾਤਰਾ ਵਿੱਚ ਪਾਣੀ ਦਾ ਪ੍ਰਬੰਧ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਜਿਵੇਂ ਕਿ ਇਹ ਟੂਬਿਲ ਬੋਰ ਇਹ ਇਹਨਾਂ ਦਾ ਪਾਣੀ ਵੱਡੇ ਸ਼ਹਿਰਾਂ ਵਿੱਚ ਇਹ ਪਾਣੀ ਡੂੰਘਾ ਹੁੰਦਾ ਡੁੰਘਾਈ ਕਾਰਨ ਇਹ ਅਸੀਂ ਇਹ ਪਾਣੀ ਨੂੰ ਨਹੀਂ ਵਰਤ ਸਕਦੇ ਕਿਉਂਕਿ ਪਾਣੀ ਸਾਫ਼ ਨਹੀਂ ਹੁੰਦਾ ਇਹ ਅਸੀਂ ਜਿਵੇਂ ਵਿਆਹਾਂ ਆਪਣੇ ਕੋਈ ਘਰੇਲੂ ਪ੍ਰੋਗਰਾਮਾਂ ਲਈ ਇਹ ਜਿਹੜੇ ਪਾਣੀ ਆਪਾਂ ਇਹ ਵਾਟਰ ਕੂਲਰ ਫਰੈਸ਼ ਵਾਟਰ ਨਵਾਂ ਆਪਣੇ ਇਹ ਨਵਾਂ ਸ਼ਹਿਰ ਏਰੀਏ ਵਿੱਚ ਇਹ ਚੱਲ ਰਿਹਾ ਜੋ ਕਿ ਵੀਹ ਰੁਪਏ ਦਾ ਵਾਟਰ ਕੂਲਰ ਹੈ ਉਹਦੇ ਵਿੱਚੋਂ ਵੀਹ ਲੀਟਰ ਸਾਨੂੰ ਪਾਣੀ ਮਿਲਦਾ ਹੈ ਤਾਂ ਅਸੀਂ ਉਸ ਨੂੰ ਵੀ ਇਹ ਵੱਡੇ ਉਸ ਨਾਲ ਕਰ ਸਕਦੇ ਹਾਂ ਇਹ ਬਾਕੀ ਹੋਰ ਨਵੇਂ ਇਹ ਫਰੈਸ਼ ਆਰ ਓਸ ਲਗਾ ਸਕਦੇ ਹਨ ਆਪਾਂ ਤਾਂ ਉਹਨਾਂ ਨੂੰ ਵੀ ਉਹਨਾਂ ਦੀ ਵੀ ਆਪਾਂ ਸਹੀ ਕਰ ਸਕਦੇ ਹਾਂ